ਸਤਿ ਸ਼੍ਰੀ ਅਕਾਲ ਜੀ ਹਾਂਜੀ ਭੈਣ ਜੀ ਆਓ ਜੀ ਅੱਛਾ ਜੀ ਹਾਂਜੀ ਹੈ ਹੈ ਕਿਹੜੀਆਂ ਲੈਣੀਆਂ ਨਵੀਆਂ ਲੈਣੀਆਂ ਜੇ ਕਿ ਪੁਰਾਣੀਆਂ ਲੈਣੀਆਂ ਪੁਰਾਣੀਆਂ ਲੈਣੀਆਂ ਅੱਛਿਆ ਹਾਂਜੀ ਹੈਗੀਆਂ ਪੁਰਾਣੀਆਂ ਅੱਧ ਮੁੱਲ 'ਤੇ ਮਿਲਣ ਗੀਆਂ ਜੀ ਤੁਹਾਨੂੰ ਅੱਛਾ ਜੀ ਹਾਂਜੀ ਦੱਸੋ ਕਿੰਨੀਆਂ ਲੈਣੀਆਂ ਅੱਛਾ ਜੀ ਅੱਛਾ ਜੀ ਅੱਛਾ ਪੰਜਾਬ ਬੋਰਡ ਦੀਆਂ ਲੈਣੀਆਂ ਜੀ ਓ ਅੱਛਾ ਹਾਂਜੀ ਆਹ ਪੰਜਾਬੀ ਦੀ ਆ ਹਿੰਦੀ ਹੈ ਅਤੇ ਆਹ ਦੂਸਰੀ ਤੁਸੀਂ ਵੇਖ ਲਵੋ ਹਾਂਜੀ ਵਧੀਆ ਹਾਲਤ ਦੀਆਂ ਪਈਆਂ ਹੋਈਆਂ ਨੇ ਅਜੇ ਤੱਕ ਹਾਂਜੀ ਹਾਂਜੀ ਹਾਂਜੀ ਤਿੰਨ ਤਿੰਨ ਹੋ ਗਈਆਂ ਤੁਸੀਂ ਹੁਣ ਆਪ ਵੇਖ ਲਓ ਨਾ ਵਧੀਆ ਪਈਆਂ ਹੋਈਆਂ ਨੇ ਅੱਛਾ ਜੀ ਅੱਛਾ ਜੀ ਉਹ ਵੀ ਇਹ ਹੀ ਲੈਣੀਆਂ ਉਹ ਕਿਹੜੀ ਕਿਹੜੀ ਲੈਣੀ ਅੱਛਾ ਜੀ ਅੱਛਾ ਜੀ ਮੈਥ ਦੀ ਤਾਂ ਨਹੀਂ ਹੈਗੀ ਮੈਥ ਦੀ ਨਹੀਂ ਹੈਗੀ ਮੈਥ ਦੀ ਤੁਹਾਨੂੰ ਸੋਮਵਾਰ ਮੰਗਵਾ ਦਵਾਂਗੇ ਜੀ ਹਾਂਜੀ ਹਾਂਜੀ ਅੱਛਾ ਜੀ ਕਿੰਨੇ ਵਾਲਾ ਰਜਿਸਟਰ ਚਾਹੀਦਾ ਤੁਹਾਨੂੰ ਪੰਜਾਹ ਵਾਲਾ ਹਾਂਜੀ ਆ ਲਓ ਜੀ ਇਹਦੇ ਸੱਠ ਰੁਪਈਏ ਲੱਗ ਜਾਣਗੇ ਜੀ ਤੁਹਾਨੂੰ ਇਹ ਵੱਡਾ ਨਾ ਪੇਜ ਥੋ ਥੋੜ੍ਹੇ ਜਿਹੇ ਪੇਚ ਜ਼ਿਆਦਾ ਇਹਦੇ ਹਾਂਜੀ ਅੱਛਾ ਜੀ ਹਾਂਜੀ ਆ ਦੋ ਰਜਿਸਟਰ ਹੋ ਗਏ ਜੀ ਹਾਂਜੀ ਜੀ ਹੋਰ ਅੱਛਾ ਜੀ ਹਾਂਜੀ ਕੋਈ ਗੱਲ ਨੀ ਤੁਸੀਂ ਉਹ ਜਦੋਂ ਆਪਣੇ ਬੱਚੇ ਪੜ੍ਹ ਲੈਣਗੇ ਨਾ ਤਾਂ ਆਪਣੀ ਦੁਕਾਨ 'ਤੇ ਦੇ ਜਾਇਆ ਜੇ ਤੀ ਤੀਜੇ ਹਿੱਸੇ ਦੇ ਤਾਨੂੰ ਦੇ ਦੇਵਾਂਗੇ ਕਿਹੜੀ ਕਲਾਸ ਦੇ ਨੇ ਤੁਹਾਡੇ ਕੋਲ ਅੱਛਾ ਜੀ ਹਾਂ ਕੋਈ ਗੱਲ ਨਹੀਂ ਲੈ ਆਇਆ ਜੇ ਆਪਣੀ ਦੁਕਾਨ 'ਤੇ ਹਾਂਜੀ ਲੈ ਆਇਆ ਜੇ ਟਾਈਮ ਨਾਲ ਇਹ ਨਾ ਹੋਵੇ ਵੀ ਕਲਾਸਾਂ ਵਾਲੇ ਬੱਚੇ ਫਿਰ ਲੈ ਲੂ ਜਾਂਦੇ ਨੇ ਅਤੇ ਤੁਸੀਂ ਬਾਅਦ 'ਚ ਦੇ ਕੇ ਜਾਓ ਜਿਹੜੀ ਸਾਡੀ ਵੀ ਕਿਤਾਬ ਦਾ ਲੈ ਲੱਗ ਜਾਵੇ ਇਹ ਨਾ ਫਿਰ ਪਈਆਂ ਤਾਂ ਅਸੀਂ ਫਿਰ ਕੀ ਕਰਨੀਆਂ ਹੁੰਦੀਆਂ ਸਿਲੇਬਸ ਬਾਅਦ 'ਚ ਹਾਂਜੀ ਹਾਂਜੀ ਹਾਂ ਹਾਂਜੀ ਵਾਧੂ ਪਈਆਂ ਜੀ ਚੀਜ਼ਾਂ ਸਾਰਾ ਜਮੈਟਰੀ ਵਗੈਰਾ ਪੈੱਨ ਵਗੈਰਾ ਹਰ ਇੱਕ ਚੀਜ਼ ਪਈ ਦੱਸੋ ਤੁਸੀਂ ਕਿਹੜੀ ਲੈਣੀ ਅੱਛਾ ਜੀ ਕਿਹੜੀ ਕਲਾਸ ਦੇ ਬੱਚੇ ਵਾਸਤੇ ਅੱਛਾ ਅੱਛਾ ਜੀ ਇਹ ਤਾਂ ਦੋ ਤਿੰਨ ਕਿਸਮ ਦੀਆਂ ਜੀ ਇੱਕ ਛੋਟੀਆਂ ਵੱਡੀਆਂ ਇੱਕ 'ਚ ਬਹੁਤ ਸਮਾਨ ਹੁੰਦਾ ਸਾਰਾ ਹੀ ਸਮਾਨ ਹੁੰਦਾ ਹੈ ਕਿਸੇ 'ਚ ਘੱਟ ਹੁੰਦਾ ਤੁਸੀਂ ਦੱਸੋ ਕਿਹੜੀ ਲੈਣੀ ਆ ਅੱਛਾ ਡੇਢ ਸੌ ਵਾਲੀ ਉਹ ਜਿਹੜੀ ਇੱਕ ਤਾਂ ਡੇਢ ਸੌ ਦੀ ਉਹਦੇ 'ਚ ਸਾਰਾ ਸਮਾਨ ਹੁੰਦਾ ਹੈ ਅਤੇ ਦੂਸਰੀ ਕੋਈ ਡੇਢ ਸੌ ਵਾਲੀ ਕਰ ਦਈਏ ਅੱਛਾ ਜੀ ਹਾਂਜੀ ਹਾਂਜੀ ਹੈਗੇ ਆ ਜੀ ਪਿਨ ਕਿੰਨੇ ਚਾਹੀਦੇ ਜੀ ਹੈਲੋ ਚਾਟ ਵੀ ਦੇ ਦਿੰਦੇ ਆ ਪੈਨ ਕਿਹੜਾ ਕਿਹੜਾ ਚਾਹੀਦਾ ਤੁਹਾਨੂੰ ਦੋ ਕਰ ਦਿੰਨਦੇ ਹਾਂ ਕਿਹੜਾ ਚਾਹੀਦਾ ਬਲਿਊ ਚਾਹੀਦਾ ਕਿ ਰੈਡ ਚਾਹੀਦਾ ਅੱਛਾ ਦੋਵੇਂ ਬਲਿਊ ਚਾਹੀਦੇ ਅੱਛਾ ਜੀ ਠੀਕ ਹੈ ਅਤੇ ਚੌਕ ਕਿੰਨੇ ਚਾਹੀਦੇ ਨੇ ਦੋ ਦੋ ਡੱਬਿਆਂ 'ਚ ਹੁੰਦੇ ਆ ਜੀ ਤੁਹਾਨੂੰ ਚਾਰ ਚਾਰ ਦੇ ਦਈਏ ਅੱਛਾ ਜੀ ਠੀਕ ਹੈ ਜੀ ਅੱਛਾ ਅੱਛਾ ਬੈ ਕਿਹੜਾ ਕਿਹੜਾ ਬਲੈਕ ਕਿ ਵਾਈਟ ਵਾਈਟ ਚਾਹੀਦਾ ਜੀ ਦੇਖਦੇ ਹਾਂ ਇੱਥੇ ਡੱਬਾ ਪਿਆ ਸੀ ਕਿਤੇ ਡੱਬਾ ਪਤਾ ਨਹੀਂ ਕਿੱਥੇ ਹੁਣ ਨਜ਼ਰ ਨਹੀਂ ਆ ਰਿਹਾ ਦੇਖਦੀ ਹਾਂ ਇੱਕ ਮਿੰਟ ਇੱਕ ਮਿੰਟ ਹਾਂਜੀ ਹਾਂਜੀ ਆ ਆਹ ਉੱਪਰ ਪਿਆ ਜੀ ਹਾਂਜੀ ਦਿੰਦੇ ਹਾਂ ਜੀ ਲਾਹ ਕੇ ਦਿੰਦੇ ਹਾਂ ਹਾਂਜੀ ਹਾਂਜੀ ਅੱਛਾ ਜੀ ਪੈਸੇ ਬਣਾਈਏ ਕੋਈ ਗੱਲ ਨਹੀਂ ਬਣਾਉਣੇ ਕਾਪੀ ਲਿਆ ਹਾਂਜੀ ਤਿੰਨ ਸੌ ਤੋਂ ਕੁੱਝ ਰੁਪਏ ਉੱਪਰ ਬਣਗੇ ਜੀ ਇਕਤਾਲੀ ਰੁਪਏ ਹਾਂਜੀ ਓਕੇ ਹਾਂਜੀ ਧੰਨਵਾਦ